ਪੰਜਾਬ ਵਿੱਚ ਬਹੁਤ ਸਾਰੇ ਰਾਸ਼ਟਰੀ ਪਾਰਕ ਅਤੇ ਜੂ ਹੈਗੇ ਹੈ ਜਿਵੇਂ ਕਿ ਬਠਿੰਡਾ ਮਾਨਸਾ ਚੰਡੀਗੜ੍ਹ ਵਿੱਚ ਵੀ ਹੈਗੇ ਹੈ ਅਤੇ ਮਾ ਅਸੀਂ ਜਿਵੇਂ ਆ ਕਿ ਆਪਾਂ ਦੇਖਦੇ ਹਾਂ ਕਿ ਬਠਿੰਡਾ ਅਸੀਂ ਚੰਡੀਗੜ੍ਹ 'ਚ ਵੀ ਦੇਖੇ ਹੋਏ ਆ ਅਤੇ ਬਠਿੰਡਾ ਵਿੱਚ ਵੀ ਜਿਵੇਂ ਜਿਹੜੇ ਜੂ ਬਣੇ ਹੋਏ ਆ ਉਹਨਾਂ ਵਿੱਚ ਪਾਰਕਾਂ ਵਿੱਚ ਬਹੁਤ ਫੁੱਲ ਬੂਟੇ ਹੁੰਦੇ ਹੈਗੇ ਆ ਨਵੀਆਂ ਨਵੀਆਂ ਬਨਸਪਤੀਆਂ ਵੇਖਣ ਨੂੰ ਮਿਲਦੀਆਂ ਹੈਗੀਆਂ ਅਤੇ ਫੁੱਲਾਂ ਦੀ ਖੁਸ਼ਬੂ ਸਾਡੇ ਮਨ ਨੂੰ ਲੁਭਾਉਂਦੀ ਹੈ ਵੱਖ ਵੱਖ ਫੁੱਲਾਂ ਦੀ ਖੁਸ਼ਬੂ ਹੁੰਦੀ ਹੈ ਜਿਹੜੀ ਸਾਡੇ ਮਨ ਨੂੰ ਲੁਭਾਉਂਦੀ ਹੈਗੀ ਹੈ ਅਤੇ ਜੂ ਵਿੱਚ ਅਸੀਂ ਬਹੁਤ ਸਾਰੇ ਪਸ਼ੂ ਅਤੇ ਪਕਛੀ ਸਾਰਾ ਕੁਝ ਇਹੋ ਜਿਹਾ ਕੁਝ ਅਹਿਜੇ ਅਹਿਜੇ ਵੇਖਦੇ ਹਾਂ ਪਕਛੀ ਜਿਹੜੇ ਅੱਜ ਕੱਲ੍ਹ ਆਪਾਂ ਨੂੰ ਵੇਖਣ ਨੂੰ ਉਂਝ ਨਹੀਂ ਮਿਲਦੇ ਆਪਾਂ ਸੋਚਦੇ ਹਾਂ ਕਿ ਆਹ ਤਾਂ ਬਿਲਕੁਲ ਹੀ ਖਤਮ ਹੋ ਗਏ ਹਨ ਉਹ ਵਾਲੇ ਵੀ ਉੱਥੇ ਉਹਨਾਂ ਨੇ ਵੀ ਉਹ ਦੇਖਭਾਲ ਉਹਨਾਂ ਦੀ ਕਰਦੇ ਹਾਂ ਅਤੇ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲਦੇ ਅਤੇ ਆਪਣੇ ਵੀ ਦਿਲ ਵਿੱਚ ਆਉਂਦੀ ਹੈ ਕਿ ਇਹ ਸਾਰੇ ਪਸ਼ੂ ਪਕਛੀ ਦੀਆਂ ਆਪਾਂ ਨੂੰ ਵੀ ਦੇਖ ਭਾਲ ਕਰਨੀਆਂ ਚਾਹੀਦੀਆਂ ਕਿ ਆਪਣੇ ਵੀ ਪੰਜਾਬ ਵਿੱਚ ਇਹ ਸਾਰੇ ਜਿਹੜੇ ਆਪਾਂ ਨੂੰ ਹੁਣ ਨਹੀਂ ਵੇਖਣ ਨੂੰ ਮਿਲਦੇ ਆਪਾਂ ਨੂੰ ਜੁਹੂ 'ਚ ਜਾਣਾ ਪੈਂਦਾ ਉਹਨਾਂ ਨੂੰ ਵੇਖਣ ਕਿ ਆਪਾਂ ਨੂੰ ਉਂਝ ਵੀ ਨਵਾਂ ਵ ਵੇਖਣ ਨੂੰ ਮਿਲਣ ਵੀ ਆਪਾਂ ਦੇਖਦੇ ਹਾਂ ਜਿਹੜੀਆਂ ਪਹਿਲਾਂ ਕੋਈ ਚਿੜੀਆਂ ਹੁੰਦੀਆਂ ਸੀ ਉਹ ਅੱਜ ਕੱਲ੍ਹ ਵੇਖਣ ਨੂੰ ਹੀ ਨਹੀਂ ਮਿਲਦੀਆਂ ਜੁਹੂ ਵਿੱਚ ਉਹ ਵੀ ਹੁੰਦੀਆਂ ਨੇ ਇੱਕ ਰੰਗ ਬਿਰੰਗੀਆਂ ਚਿੜੀਆਂ ਹੋ ਗਈਆਂ ਜਾਂ ਕੋਈ ਹੋਰ ਵੀ ਬਹੁਤ ਜ ਜੀਵ ਜੰਤੂ ਹੁੰਦੇ ਹੈਗੇ ਹੈ ਅਤੇ ਪਾਰਕਾਂ ਵਿੱਚ ਜਾਂਦੇ ਹਾਂ ਤਾਂ ਉੱਥੇ ਵੱਖ ਵੱਖ ਤਰ੍ਹਾਂ ਦੇ ਫੁੱਲ ਬੂਟੇ ਰੰਗ ਬਿਰੰਗੇ ਹੁੰਦੇ ਹੈਗੇ ਆ ਜਿਹੜੇ ਮਨ ਨੂੰ ਲੁਭਾਉਂਦੇ ਆ ਵਧੀਆ ਉੱਥੇ ਘਾਹ ਹੁੰਦੀ ਹੈਗੀ ਹੈ ਜਿਹੜੀ ਆਪਾਂ ਸੈਰ ਕਰ ਸਕਦੇ ਹਾਂ ਉਹਦੇ 'ਤੇ ਅਤੇ ਆਪਣੇ ਵਾਸਤੇ ਫ਼ਾਇਦੇਮੰਦ ਹੈ ਉਹ